ਪੰਜਾਬ ਵਿਚ ਕਿਸਾਨਾ ਨੂੰ ਫਸਲਾਂ ਦੀ ਬਹੁਤ ਹੀ ਚੁਣੌਤੀ ਕਰਨੀ ਪੈਂਦੀ ਹੈ ਕਿਉਂਕਿ ਇੱਥੇ ਬੇਮੌਸਮੀਆ ਬਾਰਿਸ਼ਾਂ ਬੇਮੌਸਮੇ ਤੂਫਾਨ ਆਉਦੇ ਨੇ ਜੋ ਕਿ ਫਸਲਾਂ ਦਾ ਬਹੁਤ ਹੀ ਨੁਕਸਾਨ ਕਰ ਦੇਣਗੇ ਤੇ ਜਿਹੜੀ ਖੇਤੀ ਹੈ ਸਾਰੀ ਘਾਟੇ ਵੱਲ ਈ ਜਾਂਦੀ ਹੈ ਸਰਕਾਰਾਂ ਇਹਦੇ ਵਿੱਚ ਬਹੁਤ ਹੀ ਘੱਟ ਧਿਆਨ ਦਿੰਦੀਆਂ ਨੇਗੀਆਂ ਤੇ ਸਾਨੂੰ ਸਰਕਾਰ ਵੱਲੋਂ ਜਿਹੜੀ ਹੈ ਫਸਲਾਂ ਦੀ ਐਮ ਐਸ ਪੀ ਮਿਲਣੀ ਚਾਹੀਦੀ ਹੈ ਤੇ ਬੀਮਾ ਯੋਜਨਾ ਹੋਣੀ ਚਾਹੀਦੀ ਹੈ ਤਾਂ ਕਿ ਕਿਸਾਨ ਖੁਸ਼ਹਾਲ ਹੋ ਸਕਣ ਤੇ ਆਪੋ ਆਪਣੇ ਕਿੱਤੇ ਦੇ ਵਿੱਚ ਚੰਗੀ ਕਮਾਈ ਕਰ ਸਕਣ ਧੰਨਵਾਦ